ਸਰਕਾਰ ਨੇ ਸ਼ਹਿਰਾਂ ਤੇ ਪਿੰਡਾਂ ਵਿੱਚ ਅਪਰਾਧ ਨੂੰ ਘਟਾਉਣ ਲਈ ਕਾਫੀ ਸਾਰੇ ਕਦਮ ਚੁੱਕੇ ਗਏ ਹਨ ਜਿਹਨਾਂ ਵਿੱਚ ਇਹ ਹੈ ਕਿ ਜੇਕਰ ਅਪਰਾਧ ਨੂੰ ਘਟਾਉਣਾ ਹੈ ਤਾਂ ਸਭ ਤੋਂ ਜ਼ਰੂਰੀ ਡਿਫੈਂਸ ਹੈ ਸਭ ਤੋਂ ਜ਼ਰੂਰੀ ਡਿਫੈਂਸ ਹੈ ਜੇਕਰ ਡਿਫੈਂਸ ਜਿਵੇਂ ਕਿ ਪੁਲਿਸ ਜੇ ਸਮੇਂ ਸਿਰ ਪਹੁੰਚੇਗੀ ਤਾਂ ਅਪਰਾਧ ਬਹੁਤ ਹੀ ਜ਼ਿਆਦਾ ਘਟਣਗੇ ਹੁਣ ਦੇ ਟਾਈਮ 'ਤੇ ਪੁਲਿਸ ਬਹੁਤ ਜ਼ਿਆਦਾ ਹੋ ਗਈ ਹੈ ਪਿੰਡਾਂ ਦੇ ਵਿੱਚ ਚੌਂਕੀਆਂ ਕਾਫੀ ਬਣ ਗਈਆਂ ਹਨ ਸ਼ਹਿਰਾਂ ਦੇ ਵਿੱਚ ਕਾਫੀ ਚੌਂਕੀਆਂ ਬਣ ਗਈਆਂ ਹਨ ਜਿਹਦੇ ਨਾਲ ਕਿ ਅਪਰਾਧ ਘੱਟ ਰਿਹਾ ਹੈ ਅਤੇ ਨਸ਼ਿਆਂ ਵਿਰੁੱਧ ਸਰਕਾਰ ਨੇ ਇਹ ਮੁਹਿੰਮ ਚਲਾਈ ਹੈ ਕਿ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਗਏ ਹਨ ਬਹੁਤ ਸਾਰੇ ਜਾਗਰੂਕ ਤੋਂ ਭਾਸ਼ਣ ਦਿੱਤੇ ਹਨ ਵਿੱਦਿਆ ਨੂੰ ਪੰਜਾਬ ਪੁਲਿਸ ਵੱਲੋਂ ਜਿਹਦੇ ਨਾਲ ਵੀ ਪੰਜਾਬ ਵਿੱਚ ਨਸ਼ਾ ਘਟੇ ਨਸ਼ੇ ਵਿਰੁੱਧ ਇੱਕ ਵੱਡੀ ਲਹਿਰ ਚਲਾਈ ਹੈ ਸਾਡੀ ਸਰਕਾਰਾਂ ਨੇ ਜਿਹਦੇ ਨਾਲ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਨੂੰ ਦੂਰ ਰਹਿਣ ਅਤੇ ਖੇਡਾਂ ਨੂੰ ਉਤਸ਼ਾਹਿਤ ਹੋਣਾ ਖੇਡਾਂ ਬਹੁਤ ਜ਼ਰੂਰੀ ਹਨ ਸਾਡੇ ਲਈ ਜੇਕਰ ਨੌਜਵਾਨ ਖੇਡਣਗੇ ਅੱਗੇ ਵਧਣਗੇ ਤਾਂ ਨਸ਼ਿਆਂ ਵੱਲ ਬਿਲਕੁਲ ਵੀ ਨਾ ਜਾਣਗੇ ਇਸ ਨਾਲ ਅਪਰਾਧ ਵੀ ਘਟਣਗੇ ਅਤੇ ਨਸ਼ਾ ਵੀ ਬਹੁਤ ਜ਼ਿਆਦਾ ਘਟੇਗਾ ਅਤੇ ਅਪਰਾਧ ਨੂੰ ਘਟਾਉਣ ਲਈ ਪੁਲਿਸ ਕਾਫੀ ਜ਼ਿਆਦਾ ਹੋ ਗਈ ਹੈ ਡਿਫੈਂਸ ਦੀ ਹੁਣ ਕਾਫੀ ਜ਼ਿਆਦਾ ਮਹੱਤਵ ਵੱਧ ਗਈ ਹੈ ਥਾਂ ਥਾਂ 'ਤੇ ਡਿਫੈਂਸ ਹੈ ਕਈ ਵਾਰ ਕਿਸੇ ਵੀ ਥਾਂ 'ਤੇ ਅਪਰਾਧ ਕੋਈ ਵੀ ਜੁਰਮ ਹੋ ਰਿਹਾ ਹੁੰਦਾ ਹੈ ਤਾਂ ਸਾਡੀ ਪੁਲਿਸ ਉਸ ਜਗ੍ਹਾ ਦੇ ਨਾਲ ਹੀ ਨਾਲ ਹੀ ਚਲੀ ਜਾਂਦੀ ਹੈ ਅਤੇ ਨਸ਼ੇ ਨੂੰ ਘਟਾਉਣ ਲਈ ਵੀ ਪਿੰਡਾਂ ਦੇ ਸਰਪੰਚਾਂ ਨੇ ਮਤੇ ਪਾਸ ਕੀਤੇ ਹਨ ਵੀ ਜੇਕਰ ਕੋਈ ਵੀ ਬੰਦਾ ਇਨਸਾਨ ਨਸ਼ਾ ਵੇਚੇਗਾ ਤਾਂ ਉਸਨੂੰ ਪਿੰਡ ਤੋਂ ਬਾਹਰ ਕੱਢਿਆ ਜਾਵੇਗਾ